ਗਲੇ ਨੂੰ ਠੀਕ ਕਰਨ ਲਈ ਪਹਿਲਾਂ ਤਾਂ ਸਾਨੂੰ ਡੋਕਟਰ ਕੋਲ ਜਾਣਾ ਚਾਹੀਦਾ ਹੈ ਅਗਰ ਡੋਕਟਰ ਤੋਂ ਫਰਕ ਨਹੀਂ ਪੈਂਦਾ ਤਾਂ ਸਾਨੂੰ ਘਰ ਵਿੱਚ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਨੇ ਚਾਹੀਦੇ ਨੇ ਅਗਰ ਉਸ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਸਾਨੂੰ ਮਲੱਠੀ ਵਗੈਰਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਗਰ ਉਸ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਗਲੇ ਨੂੰ ਵਿਕਸ ਲਗਾ ਕੇ ਉਸਨੂੰ ਗਰਮੈਸ਼ ਵਿੱਚ ਰੱਖਣਾ ਚਾਹੀਦਾ ਹੈ ਅਤੇ ਆਪਣੇ ਗਲੇ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ